ਅੱਜ ਕੱਲ ਆਪਾਂ ਦੇਖਦੇ ਹੀ ਆ ਜਿਵੇਂ ਸਮਾਜ ਦੇ ਵਿੱਚ ਡਾਂਸਰ ਹੁੰਦੇ ਆ ਉਹਨਾਂ ਨੂੰ ਬਹੁਤ ਸਾਰੀਆਂ ਚੁਨੌਤੀਆਂ ਦਾ ਜਿਹੜਾ ਸਾਹਮਣਾ ਹੈਗਾ ਕਰਨਾ ਪੈਂਦਾ ਅੱਜ ਕੱਲ ਲੋਕ ਐ ਉਹ ਵਿਆਹ ਸ਼ਾਦੀਆਂ ਤੇ ਡਾਂਸਰਸ ਨੂੰ ਬੁਲਾਉਂਦੇ ਹੈਗੇ ਹਗੇ ਠੀਕ ਹੈ ਕਈ ਵਾਰੀ ਡਾਂਸਰ ਹੁੰਦੇ ਆ ਕਈਆਂ ਦਾ ਮਨ ਸਾਫ ਹੁੰਦਾ ਹੈਗਾ ਪਰ ਕਈ ਡਾਂਸ ਹੁੰਦੇ ਹੈਗੇ ਜਿਨਾਂ ਦਾ ਮਨ ਹੈਗਾ ਜਿਹੜਾ ਉਹ ਮੈਲ ਦੇ ਨਾਲ ਭਰਿਆ ਹੁੰਦਾ ਵਿਆਹ ਸ਼ਾਦੀਆਂ ਚ ਵੀ ਕਈ ਲੋਕ ਅਜਿਹੇ ਹੁੰਦੇ ਆ ਅੱਜ ਕੱਲ ਜਿਵੇਂ ਆਪਾਂ ਮੁੰਡੇ ਹੀ ਦੇਖ ਲਈਏ ਕਈ ਸ਼ਰਾਬਾਂ ਪੀ ਕੇ ਉਹ ਡਾਂਸਰਾਂ ਦੇ ਨਾਲ ਕੀ ਗੰਦੀਆਂ ਹਰਕਤਾਂ ਵਗੈਰਾ ਕਰਦੇ ਆਗੇ ਠੀਕ ਹ ਐਂਡ ਉਹਨਾਂ ਨੂੰ ਗੰਦੀ ਨਜ਼ਰ ਦੇ ਨਾਲ ਵੇਖਦੇ ਆ ਪਰ ਡਾਂਸਰਾਂ ਦਾ ਮੇਨ ਮੋਟਿਵ ਹੁੰਦਾ ਵੀ ਉਹ ਆਪਣੀ ਮਜਬੂਰੀ ਦੇ ਲਈ ਕੰਮ ਕਰਦੀਆਂ ਹੁੰਦੀਆਂ ਉਹਨਾਂ ਨੂੰ ਕੋਈ ਉਹ ਨਹੀਂ ਹੁੰਦਾ ਗਾ ਵੀ ਉਹ ਕੋਈ ਵਧੀਆ ਕੰਮ ਕਰ ਰਹੀ ਆ ਵੀ ਉਹਨਾਂ ਨੂੰ ਸਿਰਫ ਮਜਬੂਰੀ ਹੁੰਦੀ ਹੈ ਇਹ ਕੰਮ ਕਰਨਾ ਹੈਗਾ ਠੀਕ ਹੈ ਐਡ ਉਹਨਾਂ ਨੂੰ ਇਹ ਸਭ ਕੁਝ ਹ ਡਾਂਸਰ ਦੇ ਜੋ ਹੁੰਦਾ ਹੈਗਾ ਉਹਨਾਂ ਨੂੰ ਇਹ ਸਭ ਕੁਝ ਸਹਿਣਾ ਪੈਂਦਾ ਹੈਗਾ ਐਂਡ ਓਹ ਕੀ ਆ ਜਿਵੇਂ ਆਪਾਂ ਪੰਜਾਬੀ ਫਿਲਮ ਦੇ ਬਾਰੇ ਹੀ ਜਿਵੇਂ ਗੱਲ ਕਰਦੇ ਆਗੇ ਮੋਹ ਫਿਲਮ ਹੈਗੀ ਆ ਇਹਦੇ ਵਿੱਚ ਸਰਗੁਣ ਮਹਿਤਾ ਨੇ ਕਿਹਾ ਡਾਂਸਰ ਦਾ ਰੋਲ ਪਲੇ ਕੀਤਾ ਹੈਗਾ ਗਾ ਵੀ ਇਹਦੇ ਵਿੱਚ ਕੀ ਆ ਸਰਗੁਣ ਮਹਿਤਾ ਗੀ ਜਿਹੜੀ ਉਹਨੇ ਕੀ ਆ ਡਾਂਸਰਾਂ ਦੀ ਲਾਈਫ ਦੇ ਬਾਰੇ ਦੱਸਿਆ ਜਿਵੇਂ ਉਹ ਉਸ ਫਿਲਮ ਦੇ ਵਿੱਚ ਹੈਗਾ ਗਾ ਵੀ ਇੱਕ ਮੁੰਡਾ ਹੁੰਦਾ ਉਹ ਉਹਨੂੰ ਪਸੰਦ ਕਰਦਾ ਹੁੰਦਾ ਤੇ ਜੋ ਸਰਗੁਣ ਮਹਿਤਾ ਹੁੰਦੀ ਹੈਗੀ ਉਹ ਕੀ ਆਪਦੇ ਸਾਰੀ ਲਾਈਫ ਹੈਗੀ ਲਾਈਫ ਦੇ ਬਾਰੇ ਉਹਨੂੰ ਦੱਸਦੀ ਆ ਵੀ ਉਹ ਇੱਕ ਡਾਂਸਰ ਹੈਗੀ ਹੈਗੀ ਠੀਕ ਹੈ ਐਂਡ ਉਹ ਦੱਸਦੀ ਹੈਗੀ ਆ ਵੀ ਜੋ ਡਾਂਸਰਾਂ ਹੁੰਦੀਆਂ ਉਹਨਾਂ ਦੇ ਨਾਲ ਕੋਈ ਵਿਆਹ ਨਹੀਂ ਕਰਾਉਂਦਾ ਹੈਗਾ ਵੀ ਉਹਨਾਂ ਨੂੰ ਉਹੀ ਸਮਝਦੇ ਹੁੰਦੇ ਹੈਗੇ ਉਹਨਾਂ ਨੂੰ ਮੁੰਡੇ ਵੀ ਬਹੁਤ ਜਿਆਦਾ ਤੰਗ ਕਰਦੇ ਹੁੰਦੇ ਹੈਗੇ ਸੋ ਇਸ ਵਿੱਚ ਸਾਨੂੰ ਇਹਨੇ ਪ੍ਰੇਰਿਤ ਇਸ ਤਰ੍ਹਾਂ ਕੀਤਾ ਵੀ ਚਾਰ ਬੰਦੇ ਹੈਗੇ ਵੀ ਉਹ ਜੋ ਮਰਜ਼ੀ ਕਹੀ ਜਾਣ ਵੀ ਅਗਰ ਆਪਣੀ ਕੋਈ ਵੀ ਮਜਬੂਰੀ ਹੈਗੀ ਹੈਗੀ ਆਪਾਂ ਆਪਣੀ ਮਜਬੂਰੀ ਦੇ ਨਾਲ ਹੀ ਕੀ ਹੈਗਾ ਕੰਮ ਕਰਾਂਗੇ ਵੀ ਆਪਾਂ ਕਿਸੇ ਵੱਲ ਨਹੀਂ ਵੇਖਦੇ ਵੀ ਅਗਲਾ ਆਖੇ ਵੀ ਉਹ ਡਾਂਸਰ ਐ ਡਾਂਸਰ ਐ ਅਗਰ ਆਪਾਂ ਕਿਸੇ ਵੀ ਕੰਮ ਦੇ ਵਿੱਚ ਸਪੈਸ਼ਲਜ ਹੈਗੇ ਤਾਂ ਆਪਾਂ ਉਹੀ ਕੰਮ ਕਰਾਂਗੇ ਕੋਈ ਵੀ ਕੰਮ ਹੈਗਾ ਜਿਹੜਾ ਉਹ ਚੰਗਾ ਮਾੜਾ ਨਹੀਂ ਹੁੰਦਾ ਸੋ ਇਹੀ ਜਿਹੜੀਆਂ ਗੱਲਾਂ ਸੀਗੀਆਂ ਇਹੀ ਜੋ ਸਮਾਜ ਵਿੱਚ ਡਾਂਸਰਾਂ ਨੂੰ ਇਹ ਸਾਰੀਆਂ ਚੁਨੌਤੀਆਂ ਹੈਗੀਆਂ ਜਿਹੜੀਆਂ ਉਹਨਾਂ ਦਾ ਕੀ ਆ ਸਾਹਮਣਾ ਕਰਨਾ ਪੈਂਦਾ